ਪੰਜਾਬ ਰਾਜ ਦੇ ਜੇ ਆਪਾਂ ਆਲੇ ਦੁਆਲੇ ਘੁੰਮਣਾ ਹੋਵੇ ਤਾਂ ਆਪਾਂ ਕਾਫੀ ਤਰ੍ਹਾਂ ਦੇ ਜਿਹੜੇ ਯੂ ਵਰਤ ਸਕਦੇ ਹਾਂ ਆਵਾਜਾਈ ਦੇ ਤਰੀਕੇ ਤੁਸੀਂ ਟੈਕਸੀ ਕਰ ਸਕਦੇ ਹੋ ਤੁਸੀਂ ਆਟੋ ਰਿਕਸ਼ਾ ਕਰ ਸਕਦੇ ਹੋ ਤੁਸੀਂ ਲੋਕਲ ਬੱਸ 'ਤੇ ਜਾ ਸਕਦੇ ਹੋ ਜਾਂ ਤੁਸੀਂ ਆਪਦੇ ਦੋ ਪਹੀਆਂ ਵਾਲੇ ਵਾਹਨ ਜਿਸ ਤਰ੍ਹਾਂ ਮੋਟਰ ਬਾਈਕ ਹੋ ਗਏ ਐਕਟੀਵਾ ਸਕੂਟਰ ਹੋ ਗਏ ਤੁਸੀਂ ਉਹਨਾਂ 'ਤੇ ਜਾ ਸਕਦੇ ਹੋ ਪਰ ਜੇ ਮੈਨੂੰ ਪੁੱਛੋ ਤਾਂ ਮੈਨੂੰ ਜਿਸ ਤਰ੍ਹਾਂ ਕਿ ਅਸੀਂ ਜਾਂਦੇ ਪੰਜਾਬ ਤੋਂ ਬਾਹਰ ਜਾਂਦੇ ਪੰਜਾਬ ਦੇ ਵਿੱਚ ਹੀ ਘੁੰਮਣਾ ਹੈ ਤਾਂ ਮੈਨੂੰ ਕਾਰਾਂ ਜਿਹੜੀਆਂ ਅੱਜ ਕੱਲ੍ਹ ਉੱਪਰ ਤੋਂ ਓਪਨ ਵਾਲੀਆਂ ਆਈਆਂ ਹਨ ਉਹ ਵਾਲੀ ਕਾਰ ਮੈਨੂੰ ਬਹੁਤ ਪਸੰਦ ਹੈ ਉੱਥੇ ਤੁਹਾਨੂੰ ਇਹ ਕਿ ਤੁਹਾਨੂੰ ਉੱ ਜੇ ਤੁਸੀਂ ਉੱਪਰਲੀ ਛੱਤ ਦਾ ਖੋਲ੍ਹ ਲਉ ਤਾਂ ਤੁਹਾਨੂੰ ਬਾਹਰਲੇ ਨਜ਼ਾਰਾ ਵੀ ਦਿੱਖਦਾ ਅਤੇ ਪੂਰੀ ਕਾਰ ਦੇ ਵਿੱਚ ਰੋਸ਼ਨੀ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਕਰਕੇ ਘੁੰਮਣ ਵਾਸਤੇ ਮੈਨੂੰ ਤਾਂ ਆਲੇ ਦੁਆਲੇ ਘੁੰਮਣ ਲਈ ਕਾਰ ਦਾ ਜ਼ਿਆਦਾ ਪਸੰਦ ਆਉਂਦਾ ਆਟੋ ਰਿਕਸ਼ਾ ਵੀ ਵਧੀਆ ਲੱਗਦਾ ਪਰ ਉਹਦੇ ਵਿੱਚ ਇਹ ਹੈ ਕਿ ਤੁਹਾਡੇ 'ਤੇ ਹੰਪਨ 'ਤੇ ਬਹੁਤ ਜ਼ਿਆਦਾ ਝਟਕੇ ਵੱਜਦੇ ਹਨ ਇਸ ਲਈ ਮੈਂ ਕਿਤੇ ਵੀ ਜਾਣ ਲਈ ਮੈਨੂੰ ਕਾਰ ਜ਼ਿਆਦਾ ਪਸੰਦ ਆਉਂਦੀ ਹੈ